ਹੈਲੋ ਜੀ ਓਲਾ ਐਪ ਤੋਂ ਗੱਲ ਕਰ ਰਹੇ ਹੋ ਡਰਾਈਵਰ ਮੈਂ ਨਾ ਇੱਕ ਕੈਬ ਬੁੱਕ ਕਰਨੀ ਚਾਹੁੰਦਾ ਜਿਵੇਂ ਕਿ ਅੱਜ ਪੰਜ ਜੁਲਾਈ ਦੋ ਹਜ਼ਾਰ ਤੇਈ ਹੈ ਅਤੇ ਮੈਂ ਚਾਹੁੰਦਾ ਹੈ ਕਿ ਮੈਂ ਦਸ ਤਰੀਕ ਦੋ ਹਜ਼ਾਰ ਤੇਈ ਨੂੰ ਤੁਹਾਡੀ ਕੈਬ ਬੁੱਕ ਕਰ ਲਾਂ ਉਸ ਲਈ ਮੈਂ ਚੰਡੀਗੜ੍ਹ ਤੋਂ ਰੋਪੜ ਬੱਸ ਸਟੈਂਡ ਆਵਾਂਗਾ ਜੋ ਕਿ ਸਮਾਂ ਰਹੇਗਾ ਦੁਪਹਿਰ ਇੱਕ ਵਜੇ ਦਾ ਉਸ ਤੋਂ ਬਾਅਦ ਤੁਸੀਂ ਮੈਨੂੰ ਰੋਪੜ ਆਈ ਆਈ ਟੀ ਨਿਊ ਕੈਂਪਸ ਵਿੱਚ ਛੱਡ ਦਿਓ ਉਸ ਤੋਂ ਬਾਅਦ ਮੈਂ ਆਪਣਾ ਟਾਈਮ 'ਤੇ ਪਹੁੰਚ ਜਾਵਾਂਗਾ ਕੰਮ 'ਤੇ ਅਤੇ ਪਲੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ